ਹਾਂ ਮੈਂ ਪ੍ਰਚੂਨ ਥੋਕ ਬਜ਼ਾਰਾਂ ਬਾਰੇ ਜਾਣਦਾ ਹਾਂ ਜਿਵੇਂ ਕਿ ਰਾਮ ਬਾਗ ਬੱਲੇ ਮੰਡੀ ਸਬਜ਼ੀ ਮੰਡੀ ਰਾਮ ਬਾਗ ਰਾਮ ਬਾਗ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਫਲ ਫਰੂਟ ਤੇਲ ਆਦਿ ਚੀਜ਼ਾਂ ਮਿਲਦੀਆਂ ਹਨ ਸਬਜ਼ੀ ਮੰਡੀ ਵਿੱਚ ਕਿਸਾਨ ਨੇ ਕਿਸਾਨ ਸਵੇਰੇ ਸਵੇਰੇ ਆਉਂਦੇ ਹਨ ਅਤੇ ਸਬਜ਼ੀਆਂ ਸਸਤੇ ਰੇਟ 'ਤੇ ਥੋਕ ਰੇਟ 'ਤੇ ਵੇਚਦੇ ਹਨ ਅਤੇ ਲਾਗੇ ਛਾਗੇ ਵਾਲੇ ਦੁਕਾਨਦਾਰ ਆ ਕੇ ਉੱਥੇ ਸਬਜ਼ੀਆਂ ਲੈ ਕੇ ਜਾਂਦੇ ਹਨ ਅਤੇ ਆਪਣੀ ਦੁਕਾਨਾਂ 'ਤੇ ਵਧੀਆ ਰੇਟ 'ਤੇ ਵੇਚਦੇ ਹਨ ਬੱਲੇ ਮੰਡੀ ਬੱਲੇ ਮੰਡੀ ਵਿੱਚ ਹਰ ਤਰ੍ਹਾਂ ਦੀ ਸਬਜ਼ੀ ਫਲ ਫਰੂਟ ਵਗੈਰਾ ਸਸ ਥੋਕ ਰੇਟ 'ਤੇ ਮਿਲਦੇ ਹਨ ਅਤੇ ਲੋਕ ਬੜੇ ਦੂਰੋਂ ਦੂਰੋਂ ਆਉਂਦੇ ਹਨ ਅਤੇ ਇਹ ਬੱਲੇ ਮੰਡੀ ਬਹੁਤ ਮਸ਼ਹੂਰ ਹੈ ਅਤੇ ਇੱਥੋਂ ਆਪਣੀਆਂ ਦੁਕਾਨਾਂ 'ਤੇ ਲਿਜਾ ਕੇ ਸਬਜ਼ੀਆਂ ਬਹੁਤ ਵਧੀਆ ਰੇਟ 'ਤੇ ਵੇਚਦੇ ਹਨ ਹਾਂ ਅਲ ਹਾਲ ਹੀ ਸਾਲਾਂ ਵਿੱਚ ਕਰਿਆਨੇ ਸਬਜ਼ੀਆਂ ਦੇ ਰੇ ਰੇਟ ਬਹੁਤ ਵੱਧ ਗਏ ਹਨ ਕਿਉਂਕਿ ਕਿਸਾਨ ਆਪਣੀ ਜਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਤਾਂ ਕਰਕੇ ਕੋਈ ਖੇਤੀਬਾੜੀ ਨਹੀਂ ਕਰ ਰਿਹਾ ਅਤੇ ਸਬਜ਼ੀਆਂ ਨਹੀਂ ਮਿਲ ਰਹੀਆਂ ਤਾਂ ਕਰਕੇ ਅੱਜ ਦੇ ਟਾਈਮ 'ਤੇ ਪਿਆਜ਼ ਦਾ ਰੇਟ ਅਸਮਾਨ ਛੂਹ ਰਿਹਾ ਹੈ ਤੇਲ ਦਾ ਰੇਟ ਵੀ ਅਸਮਾਨ ਛੂਹ ਰਿਹਾ ਹੈ ਅਤੇ ਆਟੇ ਦਾ ਰੇਟ ਵੀ ਅਸਮਾਨ ਛੂਹ ਰਿਹਾ ਔਨਲਾਈਨ ਸ਼ੌਪਿੰਗ ਅੱਜ ਦੇ ਟਾਈਮ 'ਤੇ ਸਹੀ ਵੀ ਹੈ ਗਲਤ ਵੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਜਲਦੀ ਸਮਾਨ ਮਿਲ ਵੀ ਜਾਂਦਾ ਹੈ ਅਤੇ ਲੇਟ ਵੀ ਮਿਲ ਜਾਂਦਾ ਹੈ ਡਿਲਵਰੀ ਕਈ ਵਾਰੀ ਜਲਦੀ ਵੀ ਹੋ ਜਾਂਦੀ ਹੈ ਅਤੇ ਲੇਟ ਵੀ ਹੋ ਜਾਂਦੀ ਹੈ ਕਈ ਵਾਰੀ ਫਰੌਡ ਵੀ ਹੋ ਜਾਂਦਾ ਹੈ ਔਨਲਾਈਨ ਖਰੀਦਦਾਰੀ ਨਾਲ ਜਿਸ ਕਰਕੇ ਸਾਨੂੰ ਔਨਲਾਈਨ ਸ਼ੌਪਿੰਗ ਘੱਟ ਵੀ ਕਰਨੀ ਚਾਹੀਦੀ ਹੈ ਅਤੇ ਕਰਨੀ ਵੀ ਹੀ ਚਾਹੀਦੀ ਹੈ